ਇਸ ਫਾਰਮ ਦੀ ਸ਼ੁਰੂਆਤ ਮੇਰੇ ਦੋਸਤ ਨੇ ਦੱਸੀ ਸੀ ਕਿ ਮਾਰਸ਼ਲ ਆਰਟ ਸਿੱਖਣਾ ਬਹੁਤ ਹੀ ਵਧੀਆ ਗੱਲ ਹੈ ਅਤੇ ਇਹ ਸਭ ਤੋਂ ਵਧੀਆ ਅਤੇ ਹਿੰਮਤ ਅਤੇ ਹੌਸਲਾ ਵਾਲੀ ਗ ਗੇਮ ਹੈ ਅਤੇ ਇਸ ਵਿੱਚ ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ਮੈਂ ਇਸ ਵਿੱਚ ਮਾਰਸ਼ਲ ਆਰਟ ਦੇ ਵਿੱਚ ਟਾਈਕਾਂਡੂ ਕਰਦਾ ਹਾਂ ਅਤੇ ਤਾਂ ਜੋ ਮੈਂ ਆਪਣਾ ਹਿੰਮਤ ਅਤੇ ਹੌਸਲਾ ਵਧਾ ਸਕਾਂ ਅਤੇ ਤਾਕਤਵਰ ਬਣ ਸਕਾਂ ਅਤੇ ਇਸ ਲਈ ਮੈਨੂੰ ਇਹ ਸਭ ਕੁਛ ਕਰਨਾ ਮੈਨੂੰ ਮਾਰਸ਼ਲ ਆਰਟਸ ਬਾਰੇ ਰੂਲਸ ਤਾਂ ਸਭ ਕੁਛ ਪਤਾ ਹੈ ਮੇ ਮੇਰੇ ਸਰ ਨੇ ਦੱਸਿਆ ਸੀ ਕਿ ਮਾਰਸ਼ਲ ਮਾਰਸ਼ਲ ਆਰਟਸ ਵਿੱਚ ਸਭ ਤੋਂ ਪਹਿਲਾਂ ਤਾਂ ਆਪਣਾ ਹਿੰਮਤ ਅਤੇ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਫਿਰ ਉਹਦੇ ਵਿੱਚ ਸਾਨੂੰ ਹਮੇਸ਼ਾ ਸਭ ਤੋਂ ਪਹਿਲੇ ਯੋਗਾ ਕਰਨੀ ਚਾਹੀਦੀ ਹੈ ਆਪਣੀਆਂ ਕਸਰਤ ਕਰਨੀ ਚਾਹੀਦੀ ਹੈ ਸਾਨੂੰ ਉਹਦੇ ਵਿੱਚ ਭੱਜਣਾ ਚਾਹੀਦਾ ਹੈ ਰਨਿੰਗ ਕਰਨੀ ਚਾਹੀਦੀ ਹੈ ਅਤੇ ਤਾਂ ਜੋ ਸਾਡੇ ਸਰੀ ਸਰੀਰ ਵਿੱਚ ਸਟੈਮੀਨਾ ਆ ਸਕੇ ਅਤੇ ਆਪਾਂ ਕਿਸੇ ਚੀਜ਼ ਨੂੰ ਸਮਝਣ ਲਈ ਹੌਸਲਾ ਅਤੇ ਹਿੰਮਤ ਰੱਖ ਸਕੀਏ ਜਿੰਨਾ ਚਿਕਰ ਇਹ ਹਿੰਮਤ ਹਿੰਮਤ ਅਤੇ ਹੌਸਲਾ ਨਹੀਂ ਆ ਸਕਦਾ ਆਪਾਂ ਓਨਾ ਚਿਕਰ ਮਾਰਸ਼ਲ ਆਰਟਸ ਨਹੀਂ ਸਿੱਖ ਸਕਦੇ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਰਸ਼ਲ ਆਰਟਸ ਸਿੱਖਣ ਲਈ ਸਾਨੂੰ ਹਮੇਸ਼ਾ ਪਹਿਲੇ ਤੋਂ ਸਭ ਤੋਂ ਪਹਿਲੇ ਤਾਂ ਆਪਣਾ ਰੂਲਸ ਬਣਾਉਣੇ ਚਾਹੀਦੇ ਹਨ ਕਿ ਕਿਵੇਂ ਮਾਰਸ਼ਲ ਆਰਟਸ ਸਿੱਖਣੀ ਆ ਮੈਨੂੰ ਇਹ ਮੇਰੇ ਦੋਸਤ ਨੇ ਦੱਸਿਆ ਸੀ ਕਿ ਕਿਵੇਂ ਉਹ ਮਾਰਸ਼ਲ ਆਰਟਸ ਸਿੱਖਦਾ ਹੈ ਅਤੇ ਕਿਵੇਂ ਉਹ ਆਪਣਾ ਇੱਕ ਦੂਜੇ ਨੂੰ ਟੈਕਲ ਕਰ ਸਕਦਾ ਹੈ ਅਤੇ ਮੈਂ ਇਹ ਵੀ ਸੁਣਿਆ ਕਿ ਉਹਦੇ ਤੋਂ ਉਹ ਮੈਡਲ ਜਿੱਤ ਕੇ ਲਿਆਉਂਦਾ ਇਸ ਲਈ ਮੈਂ ਵੀ ਇਹ ਜੁਆਇਨ ਕੀਤੀ ਅਤੇ ਮੈਨੂੰ ਇਹ ਪਤਾ ਚੱਲਿਆ ਇਸ ਤੋਂ ਬਾਅਦ ਜਦੋਂ ਮੈਂ ਆਪਣੇ ਸਕੂਲ ਦੇ ਵੱਲੋਂ ਮਾਰਸ਼ਲ ਆਰਟਸ ਦੇ ਕੋਂਪਟੀਸ਼ਨ ਵਿੱਚ ਗਿਆ ਹੈ ਸ ਗਿਆ ਸੀ ਅਤੇ ਤਾਂ ਵੀ ਮੈਂ ਉੱਥੋਂ ਗੋਲਡ ਮੈਡਲ ਜਿੱਤ ਕੇ ਲਿਆਇਆ ਅਤੇ ਤਾਂ ਜੋ ਮੇਰੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਬਹੁਤ ਖੁਸ਼ ਹੋਏ ਮੈਂ ਇੱਕ ਵਾਰੀ ਹੁਸ਼ਿਆਰਪੁਰ ਵੀ ਗਿਆ ਸੀ ਟਾਈਕਵਾਂਡੂ ਸਿੱਖ ਖੇਡਣ ਲਈ ਅਤੇ ਉੱਥੋਂ ਵੀ ਮੈਨੂੰ ਬਰੋਂਜ ਮੈਡਲ ਮਿਲਿਆ ਤਾਂ ਜੋ ਮੇਰੇ ਘਰ ਦੇ ਅਤੇ ਮੇਰੇ ਸਰ ਬਹੁਤ ਖੁਸ਼ ਹੋਏ ਅਤੇ ਮੈਂ ਇਹੀ ਚਾਹੁੰਦਾ ਹਾਂ ਕਿ ਤੁਸੀਂ ਵੀ ਮਾਰਸ਼ਲ ਆਰਟਸ ਸਿੱਖੋ ਅਤੇ ਆਪਣਾ ਹਿੰਮਤ ਅਤੇ ਹੌਸਲਾ ਵਧਾਓ